ਅੱਜ ਦਾ ਸਮਾਂ ਆਧੁਨਿਕਤਾ ਦਾ ਸਮਾਂ ਹੈ ਹਰ ਇਨਸਾਨ ਆਪਣੇ ਆਪ ਨੂੰ ਮੋਡਰਨ ਕਹਾਉਣਾ ਪਸੰਦ ਕਰਦਾ ਹੈ ਕਿਸੇ ਵੀ ਇਨਸਾਨ ਦੀ ਬੋਲੀ ਦੇ ਵਿੱਚੋਂ ਉਸ ਦੀ ਸਖਸ਼ੀਅਤ ਝਲਕਦੀ ਹੈ ਪਰ ਲੋਕਾਂ ਦੀ ਨਜ਼ਰ ਦੇ ਵਿੱਚ ਜੋ ਇਨਸਾਨ ਕਿਸੇ ਦੂਸਰੀ ਭਾਸ਼ਾ ਜਿਵੇਂ ਕਿ ਅੰਗਰੇਜ਼ੀ ਜਾਂ ਹਿੰਦੀ ਦੇ ਵਿੱਚ ਜਦੋਂ ਗੱਲ ਕਰਦਾ ਹੈ ਤਾਂ ਉਸ ਨੂੰ ਬਹੁਤ ਹੀ ਸਤਿਕਾਰਤ ਨਜ਼ਰ ਦੇ ਨਾਲ ਦੇਖਿਆ ਜਾਂਦਾ ਹੈ ਪਰ ਜੇ ਉਹੀ ਇਨਸਾਨ ਪੰਜਾਬੀ ਦੇ ਵਿੱਚ ਗੱਲ ਕਰਦਾ ਹੈ ਜੋ ਕਿ ਸਾਡੀ ਮਾਤ ਭਾਸ਼ਾ ਹੈ ਤਾਂ ਉਸ ਨੂੰ ਬਹੁਤ ਹੀ ਹੀਨ ਭਾਵਨਾ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਪੰਜਾਬੀ ਵਿੱਚ ਗੱਲ ਕਰਨ ਵਾਲਾ ਬੰਦਾ ਚੰਗੀ ਤਰ੍ਹਾਂ ਪੜ੍ਹਿਆ ਲਿਖਿਆ ਅਤੇ ਜਾਣਕਾਰੀ ਰੱਖਣ ਵਾਲਾ ਨਹੀਂ ਹੈ ਜੋ ਕਿ ਸਾਡੀ ਸੋਚ ਤੋਂ ਬਿਲਕੁਲ ਉਲਟ ਹੈ ਇਹ ਇਸ ਤਰ੍ਹਾਂ ਨਹੀਂ ਹੁੰਦਾ ਕਿਸੇ ਵੀ ਦੇਸ਼ ਦਾ ਪਤਨ ਉਦੋਂ ਹੀ ਹੁੰਦਾ ਹੈ ਜੇਕਰ ਉਸ ਦੀ ਮਾਤ ਭਾਸ਼ਾ ਨੂੰ ਦਬਾਅ ਦਿੱਤਾ ਜਾਂਦਾ ਹੈ ਕਦੇ ਵੀ ਕਿਸੇ ਨੂੰ ਵੀ ਆਪਣੀ ਮਾਤ ਭਾਸ਼ਾ ਨੂੰ ਨਹੀਂ ਛੱਡਣਾ ਚਾਹੀਦਾ ਕਿਉਂਕਿ ਮਾਤ ਭਾਸ਼ਾ ਉਹ ਭਾਸ਼ਾ ਹੁੰਦੀ ਹੈ ਜਿਹੜੀ ਅਸੀਂ ਆਪਣੇ ਮਾਤਾ ਪਿਤਾ ਤੋਂ ਆਪਣੇ ਪੁਰਖਿਆਂ ਤੋਂ ਸਿੱਖਦੇ ਹੈ ਇਸ ਦੇ ਵਿੱਚ ਅਸੀਂ ਆਪਣੀ ਸ਼ਖਸ਼ੀਅਤ ਨੂੰ ਚੰਗੀ ਤਰ੍ਹਾਂ ਦੂਸਰਿਆਂ ਦੇ ਸਾਹਮਣੇ ਪ੍ਰਕਟ ਕਰ ਸਕਦੇ ਹਾਂ ਭਾਸ਼ਾ ਕੋਈ ਮਾੜੀ ਨਹੀਂ ਹੁੰਦੀ ਹਰ ਭਾਸ਼ਾ ਨੂੰ ਸਿੱਖਣਾ ਸਾਡੇ ਲਈ ਸਤਿਕਾਰ ਦੀ ਗੱਲ ਹੁੰਦੀ ਹੈ ਸਿੱਖੋ ਹਰ ਭਾਸ਼ਾ ਨੂੰ ਅੰਗਰੇਜ਼ੀ ਨੂੰ ਵੀ ਸਿੱਖੋ ਹਿੰਦੀ ਨੂੰ ਵੀ ਸਿੱਖੋ ਉਸਦੇ ਵਿੱਚ ਵੀ ਆਪਾਂ ਗੱਲ ਕਰ ਸਕਦੇ ਹਾਂ ਪਰ ਸਾਡੀ ਜੋ ਪੰਜਾਬੀ ਭਾਸ਼ਾ ਹੈ ਉਸ ਦੇ ਵਿੱਚ ਜੇ ਅਸੀਂ ਗੱਲ ਕਰਦੇ ਹਾਂ ਤਾਂ ਸਾਡੇ ਲਈ ਮਾਣ ਦੀ ਗੱਲ ਹੋਣੀ ਚਾਹੀਦੀ ਹੈ ਨਾ ਕਿ ਸ਼ਰਮ ਦੀ ਗੱਲ ਅੱਜ ਕੱਲ੍ਹ ਦੇ ਬੱਚੇ ਜੋ ਕਿ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਬਹੁਤ ਚੁਣੌਤੀਪੂਰਨ ਸਾਹਮਣਾ ਕਰਨਾ ਪੈਂਦਾ ਹੈ ਘਰਾਂ ਦੇ ਵਿੱਚ ਮਾਤਾ ਪਿਤਾ ਦੁਆਰਾ ਪੰਜਾਬੀ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਜਦੋਂ ਕਿ ਸਕੂਲਾਂ ਦੇ ਵਿੱਚ ਉਹਨਾਂ ਨੂੰ ਅੰਗਰੇਜ਼ੀ ਜਾਂ ਹਿੰਦੀ ਦੇ ਵਿੱਚ ਗੱਲ ਕਰਨ ਲਈ ਹੀ ਮਜ਼ਬੂਰ ਕੀਤਾ ਜਾਂਦਾ ਹੈ ਕਈ ਸਕੂਲਾਂ ਦੇ ਵਿੱਚ ਤਾਂ ਪੰਜਾਬੀ ਭਾਸ਼ਾ ਨੂੰ ਬੋਲਣ 'ਤੇ ਜੁਰਮਾਨੇ ਤੱਕ ਲਗਾਏ ਜਾਂਦੇ ਨੇ ਜੋ ਕਿ ਬਹੁਤ ਹੀ ਗਲਤ ਹੈ ਅਸੀਂ ਪੰਜਾਬ ਦੇ ਵਾਸੀ ਹਾਂ ਪੰਜਾਬ ਵਿੱਚ ਰਹਿੰਦੇ ਹਾਂ ਇਸ ਲਈ ਸਾਨੂੰ ਹਮੇਸ਼ਾ ਪੰਜਾਬੀ ਮਾਂ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਸ ਨੂੰ ਬੋਲਣ ਦੇ ਵਿੱਚ ਕਦੇ ਵੀ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਇਹ ਸਾਡੇ ਲਈ ਇੱਕ ਮਾਣ ਦੀ ਗੱਲ ਹੈ ਕਿ ਅਸੀਂ ਪੰਜਾਬੀ ਹਾਂ ਕਿਉਂਕਿ ਪੰਜਾਬੀ ਬੋਲੀ ਦੀ ਲਿੱਪੀ ਗੁਰਮੁਖੀ ਲਿਪੀ ਹੈ ਇਹ ਮੰਨਿਆ ਜਾਂਦਾ ਗੁਰੂ ਦੇ ਮੁੱਖ 'ਚੋਂ ਨਿਕਲੀ ਹੋਈ ਬੋਲੀ ਇਸੇ ਕਰਕੇ ਪੰਜਾਬੀ ਨੂੰ ਗੁਰੂ ਦੀ ਬੋਲੀ ਵੀ ਕਿਹਾ ਜਾਂਦਾ ਹੈ ਸਾਨੂੰ ਕਦੇ ਵੀ ਆਪਣੇ ਗੁਰੂ ਤੋਂ ਬੇਮੁੱਖ ਨਹੀਂ ਹੋਣਾ ਚਾਹੀਦਾ ਅਤੇ ਹਮੇਸ਼ਾ ਪੰਜਾਬੀ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ